ਪੁਰਾਣੇ ਗੀਤਾਂ ਅਤੇ ਅੱਜ ਦੇ ਗੀਤਾਂ ਵਿੱਚ ਸਭ ਤੋਂ ਵੱਡਾ ਫਰਕ ਹੈ ਬੋਲਾਂ ਦਾ ਪੁਰਾਣੇ ਗੀਤਾਂ ਵਿੱਚ ਜੋ ਵੀ ਬੋਲ ਵਰਤੇ ਜਾਂਦੇ ਸੀ ਉਹ ਸਾਦੇ ਹੁੰਦੇ ਸਨ ਤੇ ਸੱਭਿਆਚਾਰਕ ਤੇ ਧਾਰਮਿਕਤਾ ਨਾਲ ਸੰਬੰਧਿਤ ਹੁੰਦੇ ਸਨ ਕਿਸੇ ਵੀ ਪ੍ਰਕਾਰ ਦੀ ਅਸ਼ਲੀਲਤਾ ਉਸ ਵਿੱਚ ਮੌਜੂਦ ਨਹੀਂ ਹੁੰਦੀ ਸੀ ਤੇ ਕਿਸੇ ਵੀ ਇਸਤਰੀ ਬਾਰੇ ਕੋਈ ਵੀ ਗਲਤ ਸ਼ਬਦ ਨਹੀਂ ਵਰਤਿਆ ਜਾਂਦਾ ਸੀ ਜੋ ਅੱਜ ਕੱਲ ਦੇ ਗੀਤ ਹਨ ਉਹ ਅਸ਼ਲੀਲਤਾ ਭਰੇ ਹੁੰਦੇ ਹਨ ਉਹਨਾਂ ਵਿੱਚ ਜੋ ਜਾਂਦੀ ਹੈ ਉਹ ਵੀ ਬਹੁਤ ਗਲਤ ਹੁੰਦੀ ਹੈ ਇਸ ਲਈ ਮੈਂ ਪੁਰਾਣੇ ਗੀਤਾਂ ਨੂੰ ਹੀ ਜਿਆਦਾ ਪਸੰਦ ਕਰਦਾ ਹਾਂ